ਹੈਲੋ ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਕੀ ਹਾਲ ਚਾਲ ਆ ਹਾਂਜੀ ਮੈਂ ਹਾਂਜੀ ਸਾਰੇ ਵਧੀਆ ਸਭ ਵਧੀਆ ਹਾਂਜੀ ਅਤੇ ਭਾਅ ਜੀ ਗੱਲ ਸੁਣੋ ਮੈਂ ਨਾ ਇੱਥੇ ਨਵਾਂ ਆਇਆ ਹਾਂ ਦਿੱਲੀ ਤੋਂ ਹਾਂਜੀ ਅਤੇ ਮੈਂ ਤੁਹਾਡੇ ਤੋਂ ਨਾ ਪੰਜਾਬ ਦੇ ਟਰਾਂਸਪੋਰਟ ਸਿਸਟਮ ਬਾਰੇ ਪੁੱਛਣਾ ਸੀਗਾ ਕਿ ਉਹ ਕਿੱਦਾਂ ਦਾ ਇੱਥੇ ਮੈਂ ਨਾ ਤਰਨ ਤਾਰਨ ਵਿਜ਼ਿਟ ਕਰਨਾ ਸੀਗਾ ਹਾਂਜੀ ਅੰਮ੍ਰਿਤਸਰ ਤਰਨ ਤਾਰਨ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਕੈਬ ਹਾਂਜੀ ਹਾਂਜੀ ਇਹਦੀ ਬੁਕਿੰਗ ਕਿੱਦਾਂ ਹੁੰਦੀ ਔਨਲਾਈਨ ਕਰਨੀ ਪੈਂਦੀ ਕਿ ਇਹਦਾ ਕੋਈ ਆਫਿਸ ਹੈਗਾ ਆ ਹਾਂਜੀ ਹਾਂਜੀ ਹਾਂਜੀ

ਚਲੋ ਥੈਂਕ ਯੂ ਭਾਅ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹਾਂਜੀ ਓਕੇ